ਮੈਨੂੰ ਮੇਰੇ ਬਚਪਨ ਤੋਂ ਹੀ ਡਰਾਇੰਗ ਕਰਨ ਦਾ ਕਾਫ਼ੀ ਜ਼ਿਆਦਾ ਸ਼ੌਂਕ ਸੀ ਅਤੇ ਮੈਂ ਆਪਣੇ ਡਰਾਇੰਗ ਆਪਣੇ ਡਰਾਇੰਗ ਟੀਚਰ ਤੋਂ ਸਿੱਖੀ ਸੀ ਉਹ ਅਕਸਰ ਹੀ ਮੈਨੂੰ ਡਰਾਇੰਗ ਕਰਨ ਦੇ ਲਈ ਸਮਝਾਉਂਦੇ ਸਨ ਅਤੇ ਮੈਨੂੰ ਡਰਾਇੰਗ ਕਰਕੇ ਇੱਕ ਕਾਫ਼ੀ ਵਧੀਆ ਜ਼ਿਆਦਾ ਵਧੀਆ ਫੀਲ ਹੁੰਦਾ ਸੀ ਜਿਸ ਕਰਕੇ ਮੈਨੂੰ ਡਰਾਇੰਗ ਦੇ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਹੈ ਮੈਂ ਅਕਸਰ ਹੀ ਆਪਣੇ ਵਿਹਲੇ ਟਾਈਮ ਦੇ ਵਿੱਚ ਡਰਾਇੰਗ ਅਤੇ ਕੁਝ ਨਾ ਕੁਝ ਬਣਾਉਂਦੀ ਰਹਿੰਦੀ ਹਾਂ ਮੈਨੂੰ ਬਣਾ ਕੇ ਕਾਫ਼ੀ ਸਕੂਨ ਮਿਲਦਾ ਹੈ ਮੈਂ ਆਪਣੀ ਲਾਈਫ ਦੇ ਵਿੱਚ ਅਕਸਰ ਹੀ ਕੁਝ ਨਾ ਕੁਝ ਪੇਂਟ ਕਰਦੇ ਹੀ ਰਹਿਣਾ ਚਾਹੁੰਦੀ ਹਾਂ ਮੈਂ ਇੱਕ ਮੈਂ ਗੁਗਲ 'ਤੇ ਸਰਚ ਕਰਕੇ ਕੋਈ ਵੀ ਪੇਂਟਿੰਗਸ ਵਗੈਰਾ ਬਣਾਉਂਦੀ ਹਾਂ ਅਤੇ ਅਤੇ ਪੇਂਟਿੰਗਸ ਨੂੰ ਫੀਲ ਕਰਕੇ ਉਹਨਾਂ ਦੀ ਇਮੋਸ਼ਨਸ ਨੂੰ ਫੀਲ ਕਰਕੇ ਇੱਕ ਪੇਂਟਿੰਗ ਬਣਾਉਂਦੀ ਹਾਂ ਜਿਹੜੀ ਕਿ ਪੇਂਟਿੰਗ ਬਹੁਤ ਹੀ ਜ਼ਿਆਦਾ ਬਿਊਟੀਫੁਲ ਹੁੰਦੀ ਹੈ ਮੈਂ ਆਪਣੇ ਸਕੂਲ ਟਾਈਮ ਦੇ ਵਿੱਚ ਇੱਕ ਕੋਠੀ ਅਤੇ ਘਰ ਦਾ ਦ੍ਰਿਸ਼ ਬਣਾਇਆ ਸੀ ਜਿਹੜਾ ਕਿ ਬਹੁਤ ਜ਼ਿਆਦਾ ਬਹੁਤ ਵਧੀਆ ਸੀ ਉਸ ਦੇ ਵਿੱਚ ਮੈਂ ਇੱਕ ਇੱਕ ਕੋਠੀ ਐਂਡ ਟ੍ਰੀ ਐਂਡ ਟ੍ਰੀ ਐਂਡ ਅਦਰ ਅਦਰ ਦਰੱਖਤ ਵਗੈਰਾ ਬਣਾਏ ਸਨ ਮੈਨੂੰ ਅਕਸਰ ਹੀ ਪੇਂਟਿੰਗ ਕਰਨੀ ਬਹੁਤ ਜ਼ਿਆਦਾ ਪਸੰਦ ਹੈ ਅਤੇ ਮੈਂ ਪੇਂਟਿੰਗ ਕਰਨੀ ਬਹੁਤ ਜ਼ਿਆਦਾ ਪਸੰਦ ਕਰਦੀ ਹਾਂ ਮੈਂ ਆਪਣੇ ਫਰੈਂਡ ਦੇ ਲਈ ਇੱਕ ਸਕੈੱਚ ਤਿਆਰ ਕੀਤਾ ਸੀ ਜਿਹੜਾ ਕਿ ਉਸਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ ਮੈਨੂੰ ਆਟ ਕਟਾਫ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਮੈਂ ਉਸ ਨੂੰ ਉਸਦਾ ਨਾਮ ਦੀ ਇੱਕ ਪੇਂਟਿੰਗ ਬਣਾ ਕੇ ਉਸਨੂੰ ਗਿਫਟ ਕੀਤੀ ਸੀ ਅਤੇ ਉਸਨੂੰ ਇਹ ਪੇਂਟਿੰਗ ਬਹੁਤ ਹੀ ਜ਼ਿਆਦਾ ਪਸੰਦ ਆਈ ਸੀ ਉਸ ਪੇਂਟਿੰਗ ਦੇ ਵਿੱਚ ਮੈਂ ਇੱਕ ਹਾਰਟ ਅਤੇ ਉਸਦਾ ਨਾਮ ਨੂੰ ਕਾਫ਼ੀ ਦੁ ਕਾਫ਼ੀ ਸੁੰਦਰ ਤਰੀਕੇ ਦੇ ਨਾਲ ਬਣਾਇਆ ਸੀ ਜਿਸ ਨੂੰ ਦੇਖ ਕੇ ਉਸ ਨੂੰ ਕਾਫ਼ੀ ਵਧੀਆ ਲੱਗਿਆ ਅਤੇ ਉਸਨੇ ਮੈਨੂੰ ਕਿਹਾ ਕਿ ਇਹ ਪੇਂਟਿੰਗ ਤੂੰ ਬਹੁਤ ਹੀ ਵਧੀਆ ਬਣਾਉਂਦੀ ਹੈ ਅਤੇ ਮੈਂ ਅਕਸਰ ਹੀ ਪੇਂਟਿੰਗਸ ਬਣਾ ਕੇ ਆਪਣੇ ਮਾਇੰਡ ਨੂੰ ਰੀਲੈਕਸ ਕਰਦੀ ਰਹਿੰਦੀ ਹਾਂ ਅਤੇ ਮੈਨੂੰ ਕ ਚਿੱਤਰਕਾਰੀ ਕਰਨਾ ਆਪਣੇ ਬਚਪਨ ਤੋਂ ਹੀ ਪਸੰਦ ਹੈ ਇਸ ਦੇ ਵਿੱਚ ਇਮੋਸ਼ਨਸ ਐਂਡ ਫੀਲਿੰਗਸ ਨੂੰ ਫੀਲ ਕਰਨਾ ਹੀ ਪੇਂਟਿੰਗ ਸਮਝਦੀ ਹਾਂ ਪੇਂਟਿੰਗਜ਼ ਕਾਫ਼ੀ ਜ਼ਰੂਰੀ ਹੁੰਦੀ ਹੁੰਦੀਆਂ ਹਨ ਅਤੇ ਮੈਂ ਪੇਂਟਿੰਗ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਮੈਨੂੰ ਕਲਰਸ ਐਡ ਪੇਂਟਿੰਗਸ ਬਹੁਤ ਜ਼ਿਆਦਾ ਪਸੰਦ ਹਨ